ਸਤਿ ਸ਼੍ਰੀ ਅਕਾਲ ਹਾਂ ਮੈਂ ਕਿਸਾਨਾਂ ਦਾ ਮੁੱਖ ਮੁੱਖ ਧੰਦਾ ਤਾਂ ਖੇਤੀਬਾੜੀ ਹੀ ਹੈ ਪਰ ਖੇਤੀਬਾੜੀ ਦੇ ਨਾਲ ਹੋਰ ਵੀ ਕੰਮ ਕਰਨ ਲੱਗ ਪਏ ਹਨ ਕਿਸਾਨ ਜਿਵੇਂ ਕਿ ਮਧੂਮੱਖੀ ਡੇਅਰੀ ਫਾਰਮ ਅਤੇ ਪਸ਼ੂ ਪਾਲਣ ਅਤੇ ਪਾਲਣ ਦਾ ਕੰਮ ਵੀ ਕਰਦੇ ਹਨ ਕਣਕ ਚੌਲਾਂ ਤੋਂ ਇਲਾਵਾ ਫਲਾਂ ਦੀ ਖੇਤੀਬਾੜੀ ਸਬਜ਼ੀਆਂ ਦੀ ਖੇਤੀਬਾੜੀ ਅਤੇ ਹੋਰ ਤਰ੍ਹਾਂ ਦੇ ਧੰਦੇ ਕਰਨ ਲੱਗ ਪਏ ਹਨ ਕਿਸਾਨ ਘਰ ਦਾ ਗੁੜ ਕੱਢ ਕੇ ਵੀ ਵੇਚਦੇ ਹਨ ਅਤੇ ਕਿਸਾਨ ਮੇਲਿਆਂ ਮੇ ਮੇਲੇ ਲੱਗਦੇ ਹਨ ਤਾਂ ਤੇ ਕਿਸਾਨ ਉੱਥੇ ਜਾ ਕੇ ਹਰ ਤਰ੍ਹਾਂ ਦੇ ਜਿਵੇਂ ਗੁੜ ਸ਼ਹਿਦ ਤਾਜ਼ੀਆਂ ਸਬਜ਼ੀਆਂ ਆਦਿ ਵੇਚਦੇ ਹਨ ਅਤੇ ਲੋਕ ਉੱਥੇ ਜਾ ਕੇ ਇਹ ਚੀਜ਼ਾਂ ਲਿਆ ਕੇ ਪਸੰਦ ਕਰਦੇ ਹਨ ਅਤੇ ਲੋਕ ਇਸ ਕੰਮ ਨੂੰ ਪਸੰਦ ਕਰਦੇ ਹਨ ਜੇ ਅਸੀਂ ਕਿਸਾਨਾਂ ਦੇ ਹੋਰ ਕੰਮਾਂ ਬਾਰੇ ਕਹੀਏ ਤਾਂ ਉਹ ਇੱਕ ਵੱਖਰੀ ਤਕਨੀਕ ਹੈ ਕਿ ਉਹ ਆਪਣੀ ਕਿਸਾਨੀ ਕੰਮ ਕਰਕੇ ਖੇਤੀਬਾੜੀ ਦਾ ਕੰਮ ਕਰਕੇ ਵੀ ਬਹੁਤ ਤਰ੍ਹਾਂ ਦੇ ਕੰਮ ਕਰਨ ਲੱਗ ਪਏ ਹਨ ਜਿਹੜੇ ਉਹਨਾਂ ਨੂੰ ਪਸੰਦ ਲੱਗਦੇ ਹਨ